ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਾਰਾਂ ਦੇ ਹਮਲਿਆਂ ਦਾ ਸ਼ਿਕਾਰ ਰਿਹਾ ਹੈ ਸਭ ਤੋਂ ਪਹਿਲਾਂ ਮੁਹਮੰਦ ਬਿਨ ਕਾਸਿਮ ਨੇ ਸੱਤ ਸੌ ਬਾਰ੍ਹਾਂ ਇਸਵੀ ਵਿੱਚ ਭਾਰਤ 'ਤੇ ਹਮਲਾ ਕੀਤਾ ਇਸ ਤੋਂ ਬਾਅਦ ਜਿਵੇਂ ਹੀ ਮੁਸਲਿਮ ਹਮਲਾਵਰ ਭਾਰਤ ਨੂੰ ਲੁੱਟਣ ਲਈ ਆਏ ਸਾਰਿਆਂ ਨੂੰ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ ਇਸ ਤਰ੍ਹਾਂ ਜਦੋਂ ਮੁਸਲਿਮ ਹਮਲਾਵਰ ਆਉਂਦੇ ਤਾਂ ਉਹ ਆਪਣੇ ਨਾਲ ਆਪਣੀ ਵਿਰਾਸਤ ਵੀ ਲੈ ਕੇ ਆਉਂਦੇ ਸਨ ਤਾਂ ਪੰਜਾਬੀ ਬੀ ਲੋਕਾਂ ਨੂੰ ਲੋਕ ਉਨ੍ਹਾਂ ਨੂੰ ਦੇਖ ਕੇ ਸਲਵਾਰ ਕਮੀਜ਼ ਅਤੇ ਗਹਿਣੇ ਪਹਿਨਦੇ ਪਹਿਨਣੇ ਸ਼ੁਰੂ ਕਰ ਦਿੱਤੇ ਉਨ੍ਹਾਂ ਦੇ ਖਾਣੇ ਦੀ ਨਕਲ ਕੀਤੀ ਫਿਰ ਮੁਸਲਿਮ ਅਤੇ ਪੰਜਾਬੀ ਲੋਕ ਇਕੱਠੇ ਰਹਿਣ ਰਹਿ ਰਹੇ ਸਨ ਅਤੇ ਇਸ ਮਹਾਰਾਜਿਆਂ ਅਤੇ ਰਾਜਿਆਂ ਸਮੇਂ ਵੀ ਇਨ੍ਹਾਂ ਚੀਜਾਂ ਦੀ ਉਲੰਘਣਾ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਲਈ ਅਨੇਕਾਂ ਲੜਾਈਆਂ ਲੜੀਆਂ ਅਤੇ ਸਾਡਾ ਸਾਡੇ ਦੇਸ਼ ਨੂੰ ਅਜ਼ਾਦ ਕਰਵਾਇਆ ਸ਼ਹੀਦ ਭਗਤ ਸਿੰਘ ਜੀ ਨੇ ਵੀ ਅਨੇਕਾਂ ਲੜਾਈਆਂ ਲੜੀਆਂ ਕਈ ਅਨੇਕਾਂ ਗੁਰੂਆਂ ਨੇ ਵੀ ਅਨੇਕਾਂ ਅਨੇਕਾਂ ਲੜਾਈਆਂ ਲੜ ਲੜੀਆਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਹੋਈ ਸੀ ਅਤੇ ਉਹ ਸਥਾਪਨਾ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਅਨੇਕਾਂ ਸ਼ਬਦ ਦਰਜ ਹਨ ਕਿ ਮੁਸਲਿਮ ਨੇ ਪੰਜਾਬ 'ਤੇ ਬਹੁਤ ਅੱਤਿਆਚਾਰ ਵੀ ਕੀਤੇ ਸਨ ਮੁਸਲਮਾਨਾਂ ਨੇ ਪੰਜਾਬ ਨੂੰ ਆਪਣੇ ਹਿਸਾਬ ਅਤੇ ਤੌਰ ਤਰੀਕੇ ਨਾਲ ਚਲਾਇਆ ਹੈ ਅਤੇ ਜਿਸ ਕਰਕੇ ਪੰਜਾਬ ਉਨ੍ਹਾਂ ਦਾ ਗੁਲਾਮ ਬਣ ਗਿਆ ਸੀ ਅਤੇ ਪੰਦਰ੍ਹਾਂ ਸੌ ਸਤੱਤਰ ਇਸਵੀ ਨੂੰ ਪੰਜਾਬ ਨੂੰ ਰਿਹਾਅ ਕਰਵਾਇਆ ਗਿਆ ਕਿ ਉਹ ਆਪਣੇ ਤੌਰ ਤਰੀਕਿਆਂ ਦੀ ਸੰਸਾ ਹਾਲ ਜੀਵੇ ਅਤੇ ਆਪਣੇ ਅਤੇ ਆਪਣੇ ਆਪਣੇ ਤਰੀਕਿਆਂ ਨਾਲ ਜ਼ਿੰਦਗੀ ਮਹਿਸੂਸ ਕਰੇ ਬਤੀਤ ਕਰੇ ਅਤੇ ਮੁਗਲਾਂ ਦਾ ਸਾਮਰਾਜ ਸੀ ਜਿਹੜਾ ਉਹ ਖਤਮ ਕਰ ਦਿੱਤਾ ਅਤੇ ਮੁਸਲਿਮਾਂ ਨੂੰ ਵੀ ਆਪਣਾ ਰਾਜ ਖਤਮ ਕਰ ਦਿੱਤਾ ਅਤੇ ਉਨ੍ਹਾਂ ਨੂੰ ਪੰਜਾਬ ਨੂੰ ਆਪਣਾ ਰਾਜ ਵਾਪਸ ਕਰ ਦਿੱਤਾ